ਹੈਲੋ ਨਮਸਕਾਰ ਜੀ ਮੈਂ ਰਾਜਕੁਮਾਰ ਅਰੋੜਾ ਬੋਲ ਰਿਹਾ ਮੈਂ ਆਪਣੇ ਕੁਛ ਦੋਸਤਾਂ ਨਾਲ ਨਾ ਨ ਦੋ ਚਾਰ ਦਿਨਾਂ ਦੇ ਟੂਰ ਵਾਸਤੇ ਨਾ ਵਰਿੰਦਾਵਨ ਜਾ ਰਿਹਾ ਸੀ ਰਸਤੇ 'ਚ ਹੁਣ ਇਹ ਇਹ ਲੁਧਿਆਣੇ ਦੇ ਅੱਗੇ ਥੋੜ੍ਹੀ ਸੁੰਨਸਾਨ ਜਗ੍ਹਾ ਦੇ ਕੋਲ ਥੋੜ੍ਹੀ ਇੰਨੀ ਮਤਲਬ ਕਿ ਬੈਕਵਰਡ ਏਰੀਏ ਦੇ ਕੋਲ ਮੇਰੀ ਇਹ ਗੱਡੀ ਕਾਰ ਖ਼ਰਾਬ ਹੋ ਗਈ ਹੈ ਉੱਧਰੋਂ ਬਾਰਿਸ਼ ਵੀ ਬੜੀ ਹੋ ਰਹੀ ਹੈ ਅਤੇ ਹੁਣ ਤੁਹਾਨੂੰ ਕਾਫੀ ਸਾਨੂੰ ਆਸੇ ਪਾਸੇ ਕੋਈ ਖਾਣ ਪੀਣ ਦੀ ਜਗ੍ਹਾ ਵੀ ਕੋਈ ਰੈਸਟੋਰੈਂਟ ਕੋਈ ਹੋਟਲ ਐਰਾ ਵਗੈਰਾ ਨਜ਼ਰ ਨਹੀਂ ਆ ਰਿਹਾ ਥੋੜ੍ਹੇ ਨੇ ਸਾਈਡ 'ਤੇ ਹੈਗੀ ਥੋੜ੍ਹੀ ਇੰਨੀ ਪਿੰਡ ਪੇਂਡੂ ਇਲਾਕਾ ਹੈਗਾ ਤਾਂ ਕੀ ਤੁਹਾਡੀ ਕੰਪਨੀ ਸਾਨੂੰ ਇੱਥੇ ਫੂਡ ਵ ਪ੍ਰੋਵਾਈਡ ਕਰ ਸਕਦੀ ਹੈ ਜੀ ਤੁਹਾਨੂੰ ਪੱਕਾ ਵਗੈਰਾ ਰੋਟੀ ਪਾਣੀ ਮਿਲ ਜਵੇ ਥੋੜ੍ਹਾ ਜਿਹਾ ਨਾ ਤਾਂ ਕਿ ਅਸੀਂ ਢਿੱਡ ਭਰ ਲਈਏ ਹੈਂਜੀ ਅਤੇ ਮੈਂ ਤੁਹਾਨੂੰ ਕਰਾ ਸਕਦੀ ਹੈ ਠੀਕ ਹੈ ਅਤੇ ਚਲੋ ਜੇ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਭੇਜ ਦਿੰਦਾ ਅਤੇ ਕੋਸ਼ਿਸ਼ ਕਰੋ ਚਲੋ ਜਿਹੜਾ ਵੀ ਲੜਕਾ ਆਵੇ ਮੋਟਰਸਾਇਕਲ 'ਤੇ ਬਾਰਿਸ਼ ਵੀ ਹੋ ਰਹੀ ਉਹਨੂੰ ਚੰਗੀ ਤਰ੍ਹਾਂ ਕਵਰ ਹੋ ਜਾਵੇ ਅਤੇ ਖਾਣਾ ਵੀ ਕਵਰ ਕਰਕੇ ਹੀ ਜੇ ਚੰਗੀ ਤਰ੍ਹਾਂ ਭੇਜਣਾ ਇਹ ਨਾ ਹੋਵੇ ਖਾਣਾ ਗਿੱਲਾ ਹੋ ਜਾਵੇ ਫਿਰ ਉਹਦਾ ਫਾਇਦਾ ਕੀ ਹੋਣਾ ਅਤੇ ਪਲੀਜ਼ ਤੁਹਾਨੂੰ ਇਹ ਮੈਂ ਤੁਹਾਨੂੰ ਆਪਣਾ ਔਡਰ ਅਤੇ ਭੇਜ ਦਿੰਦਾ ਅਤੇ ਵੀ ਸਾਨੂੰ ਕੀ ਕੀ ਚਾਹੀਦਾ ਆ ਅਤੇ ਮੈਨੂੰ ਪਲੀਜ਼ ਇਹ ਖਾਣਾ ਪ੍ਰੋਵਾਈਡ ਕਰ ਦਿਓ ਚ ਚਾਰ ਬੰਦਿਆਂ ਦੇ ਚਾਰ ਬੰਦੇ ਹਾਂ ਅਸੀਂ ਮਿਹਰਬਾਨੀ